ਅਸੀਂ ਆਪਣੇ ਦੁਆਰਾ ਬਣਾਏ ਗਏ ਚਿੱਤਰਾਂ ਨੂੰ ਕਈ ਤਰ੍ਹਾਂ ਨਾਲ ਬਚਾ ਸਕਦੇ ਹਾਂ ਜਿਵੇਂ ਅਸੀਂ ਉਹਨੂੰ ਲੈਮੀਨੇਸ਼ਨ ਵੀ ਕਰ ਸਕਦੇ ਹਾਂ ਫਰੇਮਿੰਗ ਵੀ ਕਰ ਸਕਦੇ ਹਾਂ ਅਤੇ ਮੋਮ ਕੋਟਿੰਗ ਵੀ ਕਰ ਸਕਦੇ ਹਾਂ ਕਈ ਕੈਨਵਸ ਇਹੋ ਜਿਹੇ ਹੁੰਦੇ ਹੈ ਜਿਨ੍ਹਾਂ 'ਤੇ ਕੁਛ ਨਹੀਂ ਹੋ ਸਕਦਾ ਕਿਉਂਕਿ ਰੰਗਾਂ ਦਾ ਉਪਯੋਗ ਹੀ ਕੀਤਾ ਉਸ ਤਰ੍ਹਾਂ ਹੁੰਦਾ ਹੈ ਜਿਵੇਂ ਅਸੀਂ ਨਾਈਫ ਪੇਂਟਿੰਗ ਕਰਦੇ ਹਾਂ ਉਹਦੇ ਵਾਸਤੇ ਅਗਰ ਅਸੀਂ ਉਹਦੇ 'ਤੇ ਫਰੇਮਿੰਗ ਕਰਦੇ ਹਾਂ ਅਤੇ ਉਹਦੀ ਜਿਹੜੀ ਹੈਗੀ ਹੈ ਖੂਬਸੂਰਤੀ ਛੁੱਪ ਜਾਂਦੀ ਹੈ ਉਹਦੇ ਵਾਸਤੇ ਅਸੀਂ ਸਿੰਪਲ ਫਰੇਮਿੰਗ ਕੀਤੀ ਜਾਂਦੀ ਅਤੇ ਅਸੀਂ ਮੋਮ ਦੀ ਕੋਟਿੰਗ ਕਰ ਸਕਦੇ ਹਾਂ